ਹਾਂਜੀ ਸਾਡੇ ਸ਼ਹਿਰ ਬੇ ਰੋਪੜ ਦੇ ਵਿੱਚ ਬੇਲਾ ਚੌਕ ਵਿੱਚ ਇੱਕ ਬਹੁਤ ਵੱਡੀ ਤਾਦਾਦ ਵਿੱਚ ਇੱਕ ਜਗਰਾ ਭ ਭਾਰੀ ਜਗਰਾਤਾ ਕੀਤਾ ਗਿਆ ਸੀ ਵੈਸੇ ਮੈਂ ਉੱਥੇ ਉੱਥੇ ਜਦੋਂ ਗਿਆ ਤਾਂ ਉੱਥੇ ਇੰਨੀਆਂ ਇੰਨਾ ਇੱਕਠ ਸੀ ਕਿ ਦੂਰ ਦੂਰ ਤੱਕ ਬੰਦੇ ਦਿੱਖ ਨਹੀਂ ਰਹੇ ਸੀ ਅਤੇ ਜਦੋਂ ਜਗਰਾਤਾ ਫਿਰ ਸਟਾਰਟ ਹੋਇਆ ਸਭ ਤੋਂ ਪਹਿਲਾਂ ਭਜਨ ਕੀਰਤਨ ਵਗੈਰਾ ਹੋਇਆ ਪਰ ਉਸ ਤੋਂ ਬਾਅਦ ਬਾਰਾਂ ਇੱਕ ਵਜੇ ਜਦੋਂ ਝਾਕੀਆਂ ਆਈਆਂ ਤਾਂ ਉਹਦੇ ਵਿੱਚ ਮੈਨੂੰ ਸਭ ਤੋਂ ਖਤਰਨਾਕ ਕਾਲੀ ਮਾਤਾ ਦੀ ਝਾਕੀ ਲੱਗੀ ਜਿਹਦੇ ਵਿੱਚ ਉਹਨਾਂ ਨੇ ਭੂਤ ਨੂੰ ਮਾਰਿਆ ਸੀਗਾ ਅਤੇ ਉਹ ਉਹ ਉਹ ਝਾਕੀ ਦਾ ਦ੍ਰਿਸ਼ ਇੰਨਾ ਖਤਰਨਾਕ ਸੀ ਕਿ ਮਾਤਾ ਨੂੰ ਦੇਖ ਕੇ ਇਸ ਇੱਕ ਟਾਇਮ ਨੂੰ ਅਸੀਂ ਵੀ ਸੋਚਦੇ ਸੀ ਜਿਵੇਂ ਸ਼ਾਖਸ਼ਾਤ ਮਾਤਾ ਉੱਥੇ ਪ੍ਰਗਟ ਹੋ ਗਈ ਹੈ ਅਤੇ ਲੋਕ ਲੋਕ ਆਪ ਦੇਖ ਦੇਖ ਕੇ ਉੱਥੇ ਡਰ ਰਹੇ ਸੀ ਭੂਤ ਦਾ ਵੀ ਜਿਹੜਾ ਮੇਕਅੱਪ ਹੈ ਉਹ ਇੰਨਾ ਖਤਰਨਾਕ ਕੀਤਾ ਗਿਆ ਸੀ ਕਿ ਬੱਚੇ ਤਾਂ ਨੇੜੇ ਤੇੜੇ ਵੀ ਨਹੀਂ ਹੋ ਰਹੇ ਸੀ ਚੀਕਾਂ ਮਾਰ ਮਾਰ ਕੇ ਭੱਜ ਰਹੇ ਸੀ ਅਤੇ ਉਸ ਤੋਂ ਬਾਅਦ ਰਾਧਾ ਕ੍ਰਿਸ਼ਨ ਜੀ ਜਿਹੜੀ ਝਾਕੀ ਸੀ ਉਹ ਵੀ ਬਹੁਤ ਵਧੀਆ ਸੀ ਉਹਨਾਂ ਨੇ ਜੋ ਹੈ ਉਸ ਤੋਂ ਬਾਅਦ ਜਿਹੜਾ ਡਰ ਲੋਕਾਂ ਦੇ ਅੰਦਰ ਬੈਠਿਆ ਹੋਇਆ ਸੀ ਰਾਧਾ ਕ੍ਰਿਸ਼ਨ ਜੀ ਦੀ ਝਾਕੀ ਨੇ ਉਹ ਸਾਰਾ ਡਰ ਖਤਮ ਕਰ ਦਿੱਤਾ